ਜਦੋਂ ਵੀ ਅਸੀਂ

ਗਾਇਨ ਵਿੱਚ ਜਦੋਂ ਵੀ ਕੋਈ ਆਪਾਂ ਗਾਇਨ ਸ਼ੁਰੂ ਕਰਦੇ ਹਾਂ ਜਾਂ ਕੋਈ ਗਾਣਾ ਗਾਉਣਾ ਚਾਹੁੰਦੇ ਹਾਂ ਅਤੇ ਉਸ ਦਾ ਅਸੀਂ ਅਭਿਆਸ ਕਰਨਾ ਹੈ ਤਾਂ ਉਸ ਵਿੱਚ ਸਾਨੂੰ ਸਾਹ ਲੈਣ ਵਿੱਚ ਕਈ ਵਾਰ ਸੁਰਾਂ ਦੇ ਹਿਸਾਬ ਨਾਲ ਬਹੁਤ ਦਿੱਕਤ ਆਉਂਦੀ ਹੈ ਅਤੇ ਇਸ ਨੂੰ ਨਿਯੰਤਰਨ ਕਰਨ ਲਈ ਲਗਾਤਾਰ ਸਾਨੂੰ ਉਹ ਗਾਣਾ ਵੀ ਸੁਣਨਾ ਪੈਂਦਾ ਹੈ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਕਿ ਕਿਹੜਾ ਸੁਰ ਕਿਸ ਪਾਸੇ ਜ਼ਿਆਦਾ ਲੱਗਦਾ ਹੈ ਅਤੇ ਕਿਸ ਪਾਸੇ ਘੱਟ ਲੱਗਦਾ ਹੈ ਅਤੇ ਸੁਰ ਲਾਉਣ ਲਈ ਸਾਨੂੰ ਸਾਹ ਲੈਣ ਲੱਗਿਆ ਦਿੱਕਤ ਨਾ ਆਏ ਕਿਉਂਕਿ ਅਗਰ ਅਸੀਂ ਸਾਹ ਲੈਣ ਲੱਗੇ ਦਿੱਕਤ ਲਵਾਂਗੇ ਤਾਂ ਸਾਡਾ ਗਾਣਾ ਵੀ ਖਰਾਬ ਹੋ ਸਕਦਾ ਹੈ ਅਤੇ ਇਸ ਲਈ ਸਾਨੂੰ ਵੱਧ ਤੋਂ ਵੱਧ ਰੋਜ਼ਾਨਾ ਅਭਿਆਸ ਦੀ ਜ਼ਰੂਰਤ ਪੈਂਦੀ ਹੈ ਅਤੇ ਸਾਨੂੰ ਦਿਨ ਦੇ ਵਿੱਚ ਵੱਧ ਤੋਂ ਵੱਧ ਚਾਰ ਤੋਂ ਪੰਜ ਵਾਰੀ ਅਭਿਆਸ ਕਰਨਾ ਚਾਹੀਦਾ ਹੈ ਤਾਂ ਜੋ ਸਾਨੂੰ ਸਾਹ ਲੈਣ ਲੱਗੇ ਵੀ ਦਿੱਕਤ ਨਾ ਆਏ ਅਤੇ ਅਸੀਂ ਇਹ ਚੀਜ਼ ਕੰਟਰੋਲ ਕਰ ਸਕੀਏ ਇਸਨੂੰ ਨਿਯੰਤਰਨ ਕਰ ਸਕੀਏ ਕਿ ਸਾਹ ਅਸੀਂ ਪਹਿਲਾਂ ਜ਼ਿਆਦਾ ਲੈਣਾ ਹੈ ਤਾਂ ਜੋ ਬਾਅਦ ਦੇ ਵਿੱਚ ਦਿੱਕਤ ਨਾ ਆਏ ਅਤੇ ਹੋਰ ਜ਼ਿਆਦਾ ਸੁਰ ਵਿੱਚ ਗਾਉਣ ਵਾਸਤੇ ਹੋਰ ਜ਼ਿਆਦਾ ਅਭਿਆਸ ਕਰਨ ਲਈ ਸਾਨੂੰ ਪੰਜ ਤੋਂ ਛੇ ਬਾਰ ਵੀ ਦਿਨ ਵਿੱਚ ਅਭਿਆਸ ਕਰਨ ਦੀ ਜ਼ਰੂਰਤ ਪੈਂਦੀ ਹੈ ਅਤੇ ਇਸ ਨਾਲ ਹੀ ਸਾਨੂੰ ਹੋਰ ਜ਼ਿਆਦਾ ਅੱਛਾ ਗਾਣਾ ਸਾਨੂੰ ਹੋ ਸਕਦਾ ਹੈ ਕਿ ਅਸੀਂ ਬਹੁਤ ਅੱਛਾ ਗਾ ਸਕਦੇ ਹਾਂ ਔਰ ਅਗਲਾ ਬੰਦਾ ਵੀ ਸਾਡੇ ਵੱਲ ਆਕਰਸ਼ਿਤ ਹੁੰਦਾ ਹੈ